ਮੈਨੂੰ ਦੌੜ ਦਾ ਬਹੁਤ ਸ਼ੌਂਕ ਹੈ ਮੈਂ ਸਾਡੇ ਲਾਗੇ ਜਦੋਂ ਵੀ ਦੌੜਾਂ ਹੁੰਦੀਆਂ ਹਨ ਤਾਂ ਮੈਂ ਉਹਨਾਂ ਵਿੱਚ ਹਿੱਸਾ ਲੈਂਦਾ ਹਾਂ ਮੈਂ ਰੋਜ਼ ਇਹ ਪੰਜ ਤੋਂ ਅੱਠ ਕਿਲੋਮੀਟਰ ਦੋੜ ਦੌੜ ਲੈਂਦਾ ਹਾਂ ਮੈਂ ਇੱਕ ਵਾਰ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਸੀ ਮੈਨੂੰ ਦੌੜ ਦੌੜ ਕੇ ਬਹੁਤ ਮਜ਼ਾ ਆਉਂਦਾ ਸੀ ਮੈਂ ਇਸ ਦੌੜ ਵਿ ਲਈ ਬਹੁਤ ਮਿਹਨਤ ਕੀਤੀ ਸੀ ਮੈਂ ਰੋਜ਼ ਹੀ ਕਈ ਕਈ ਕਿਲੋਮੀਟਰ ਤੱਕ ਦੌੜਦਾ ਹੁੰਦਾ ਸੀ ਮੈਨ ਇਸ ਵਿੱਚ ਬਹੁਤ ਆਉਂਦਾ ਹੈ